ਦੇਖਿਆ ਜਾਵੇ ਤਾਂ ਹਰ ਇੱਕ ਬੰਦਾ ਹੀ ਆਪਣੇ ਬਚਪਨ ਵਿੱਚ ਬਹੁਤ ਜ਼ਿਆਦਾ ਖੇਡਾਂ ਖੇਡਦਾ ਹੈ ਅਤੇ ਉਹ ਖੇਡਾਂ ਖੇਡ ਖੇਡ ਕੇ ਹੀ ਵੱਡਾ ਹੁੰਦਾ ਹੈ ਉਨ੍ਹਾਂ ਹੀ ਖੇਡਾਂ ਨੂੰ ਕੁਛ ਕੁ ਯਾਦ ਰੱਖਦਾ ਹੈ ਅਤੇ ਕੁਛ ਕ ਭੁੱਲ ਜਾਂਦਾ ਹੈ ਇਨ੍ਹਾਂ ਵਿਚੋਂ ਮੈਨੂੰ ਵੀ ਕੁਛ ਕੁ ਖੇਡਾਂ ਮੈਨੂੰ ਯਾਦ ਹੈ ਅੱਜ ਜੋ ਮੈਂ ਬਚਪਨ ਵਿੱਚ ਖੇਡਦਾ ਸੀ ਜਿਵੇਂ ਕਿ ਬਾਂਦਰ ਕੀਲਾ ਸੀ ਲੰਗੜਾ ਸ਼ੇਰ ਸੀ ਪਿੱਠੂ ਕਰਨਾ ਸੀ ਖੋ ਖੋ ਸੀ ਕਬੱਡੀ ਸੀ ਗੁੱਲੀ ਡੰਡਾ ਸੀ ਅੱਜ ਦੇ ਟਾਇਮ 'ਚ ਇਹ ਸਭ ਖੇਡਾਂ ਖੇਡੀਆਂ ਜਾਂਦੀਆਂ ਕੁਛ ਕੁ ਖੇਡਾਂ ਭੁੱਲ ਗਏ ਆ ਲੋਕ ਕੁਛ ਕੁ ਅੱਜ ਵੀ ਚੱਲਦੀਆਂ ਆ ਰਹੀਆਂ ਨੇ ਜਿਵੇਂ ਕਿ ਪਿੱਠੂ ਕਰਨਾ ਹੋ ਗਿਆ ਅੱਜ ਚੱਲਦਾ ਆ ਰਿਹਾ ਲੰਗੜਾ ਸ਼ੇਰ ਅੱਜ ਵੀ ਜਵਾਕ ਖੇਡਦੇ ਹੈ ਫੜਨ ਫੜੀਚੀ ਖੇਡਦੇ ਹੈ ਉਹ ਉਨ੍ਹਾਂ ਦੇ ਬਚਪਨ ਦੀਆਂ ਗੱਲਾਂ ਇਨ੍ਹਾਂ ਬਚਪਨ ਦੀਆਂ ਖੇਡਾਂ ਖੇਡ ਖੇਡ ਕੇ ਹੀ ਉਹ ਆਪਣੇ ਸਰੀਰਕ ਤੰਦਰੁਸਤੀ ਨੂੰ ਬਣਾਉਂਦੇ ਹੈ ਇਹ ਸਰੀਰਕ ਤੰਦਰੁਸਤੀ ਉਹਨਾਂ ਦਾ ਪੂਰੇ ਜੀਵਨ ਤੱਕ ਉਹਨਾਂ ਦਾ ਸਾਥ ਦਿੰਦੀ ਹੈ ਕਿਉਂਕਿ ਉਹ ਬਚਪਨ ਵਿੱਚ ਬਹੁਤ ਵਧੀਆ ਖੇਡਦੇ ਹੈ ਅਤੇ ਆਪਣੇ ਸਰੀਰ ਨੂੰ ਪੂਰਾ ਹਸਟ ਪੁਸ਼ਟ ਬਣਾ ਲੈਂਦੇ ਹੈ ਜੇਕਰ ਆਪਾਂ ਗੱਲ ਕਰਦੇ ਹਾਂ ਖੇਡਾਂ ਦੀ ਤਾਂ ਖੇਡਾਂ ਵਿੱਚ ਜਿਵੇਂ ਮੈਨੂੰ ਅੱਜ ਵੀ ਯਾਦ ਹੈ ਕਿ ਆਪਾਂ ਬਾਂਦਰ ਕੀਲਾ ਖੇਡਦੇ ਹਾਂ ਬਾਂਦਰ ਕੀਲੇ ਵਿੱਚ ਸਾਨੂੰ ਆਪਾਂ ਦੇਖਦੇ ਹਾਂ ਕਿ ਕਈ ਸਾਰੇ ਜੁਆਕ ਇਕੱਠੇ ਹੋ ਕੇ ਮਤਲਬ ਪੰਦਰਾਂ ਵੀਹ ਜੁਆਕ ਇਕੱਠੇ ਹੋ ਕੇ ਇੱਕ ਝੁੰਡ ਬਣਾ ਲੈਂਦੇ ਹੈ ਅਤੇ ਇੱਕ ਇੱਕ ਬ ਇੱਕ ਬੰਦਾ ਉੱਥੇ ਇੱਕ ਮਤਲਬ ਆਪਣੀ ਟਰਨ ਦਿੰਦਾ ਹੈ ਅਤੇ ਉਹ ਉਹਨਾਂ ਸਾਰੀਆਂ ਸਾਰਿਆਂ ਦੀਆਂ ਜੁੱਤੀਆਂ ਇਕੱਠੀਆਂ ਕਰਕੇ ਆਪਣੇ ਕੋਲ ਰੱਖ ਲੈਂਦਾ ਹੈ ਔਰ ਸਾਰੇ ਜੋ ਦੂਸਰੇ ਬੰਦੇ ਹੁੰਦੇ ਹੈ ਉਨ੍ਹਾਂ ਨੇ ਉਹ ਜੁੱਤੀਆਂ ਉਹਦੇ ਕੋਲੋਂ ਖਿੱਚਣੀਆਂ ਹੁੰਦੀਆਂ ਲੈਣੀਆਂ ਹੁੰਦੀਆਂ ਫਿਰ ਉਨ੍ਹੇਂ ਉਸ ਨੂੰ ਉਹਨਾਂ ਸਾਰੀਆਂ ਜੁੱਤੀਆਂ ਨੂੰ ਚੁੱਕਣ ਨਹੀਂ ਦੇਣਾ ਹੁੰਦਾ ਅਤੇ ਫਿਰ ਉਹ ਐਵੇਂ ਹੀ ਕਰਦਾ ਤਾਂ ਹੌਲੀ ਹੌਲੀ ਸਾਰੇ ਉਸ ਦੀਆਂ ਜੁੱਤੀਆਂ ਖਿੱਚ ਲੈਂਦੇ ਹੈ ਅਤੇ ਬਾਅਦ 'ਚ ਫਿਰ ਉਹ ਜਦੋਂ ਸਾਰੇ ਜੁੱਤੀਆਂ ਖਿੱਚ ਲੈਂਦੇ ਹੈ ਅਤੇ ਉਸਨੂੰ ਫਿਰ ਮਾਰਨਾ ਹੁੰਦਾ ਹੈ ਉਸ ਬੰਦੇ ਨੂੰ ਜੇਕਰ ਆਪਾਂ ਬਾਂਦਰ ਕੀਲੇ ਦੀ ਗੱਲ ਕਰੀਏ ਬਾਂਦਰ ਕਿੱਲਾ ਖੇਡ ਐਂਵੇ ਦੀ ਹੈ ਬਹੁਤ ਹੀ ਜ਼ਿਆਦੇ ਮਜ਼ਾ ਆਉਂਦਾ ਅਸੀਂ ਬਾਂਦਰ ਕੀਲਾ ਖੇਡਦੇ ਹੋਇਆ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰਦੇ ਹਾਂ ਕਬੱਡੀ ਦੀ ਕਬੱਡੀ ਲਈ ਵੀ ਵੈਸੇ ਤਾਂ ਬਚਪਨ 'ਚ ਇੰਨਾ ਜ਼ਿਆਦਾ ਆਪਾਂ ਨੂੰ ਪਤਾ ਤਾਂ ਨਹੀਂ ਹੁੰਦਾ ਕਿ ਕਿਵੇਂ ਖੇਡਣਾ ਹੈ ਕਿਵੇਂ ਨਹੀਂ ਖੇਡਣਾ ਉਵੇਂ ਹੀ ਬਸ ਚੱਲ ਜਾਂਦੇ ਸੀ ਕਬੱਡੀ ਖੇਡਣ ਲਈ ਬਚਪਨ 'ਚ ਉੱਥੇ ਵਧੀਆ ਜਾ ਕੇ ਮਤਲਬ ਇੱਕ ਜਗ੍ਹਾ ਬਣੀ ਹੁੰਦੀ ਸਾਡੇ ਤਾਂ ਅਸੀਂ ਉੱਥੇ ਜਾ ਕੇ ਬੈਠ ਜਾਣਾ ਅਤੇ ਥੋੜ੍ਹੇ ਟਾਇਮ ਬਾਅਦ ਕਬੱਡੀ ਖੇਡਣ ਲੱਗ ਜਾਣਾ ਉਹਦੇ ਵਿੱਚ ਅਸ ਅਸੀਂ ਹੁੰਦੇ ਮਤਲਬ ਜ਼ਿਆਦਾ ਤਾਂ ਪਤਾਂ ਨਹੀਂ ਹੁੰਦਾ ਸੀ ਕਿ ਕਿੰਨੇ ਕੁ ਬੱਚੇ ਉਹਦੇ 'ਚ ਖੇਡ ਸਕਦੇ ਆ ਕਿੰਨੇ ਨਹੀਂ ਖੇਡ ਸਕਦੇ ਬਸ ਜਿੰਨੇ ਕੁ ਅਸੀਂ ਹੁੰਦੇ ਪੰਜ ਸੱਤ ਬੱਚੇ ਖੇਡਦੇ ਵਧੀਆ ਖੇਡਦੇ ਉਹਦੇ 'ਚ ਪੰਜ ਸ ਦੋ ਚਾਰ ਵਾਰ ਬੰਦੇ ਰੇਡ ਰੇਡ ਲਈ ਆਉਂਦੇ ਅਤੇ ਦੋ ਚਾਰ ਬੰਦੇ ਜਾ ਜਾਫੀ ਹੁੰਦੇ ਸੀ ਉਹਦੇ 'ਚ ਬਸ ਐਂਵੇ ਕਰਕੇ ਵਧੀਆ ਖੇਡ ਬਣੀ ਰਹਿੰਦੀ ਅਤੇ ਬਚਪਨ ਵਧੀਆ ਜਿਵੇਂ ਆ ਗਿਆ ਜ ਉਸ ਤੋਂ ਬਾਅਦ ਥੋੜ੍ਹੇ ਟੈਮ ਬਾਅਦ ਬਸ ਐਂਵੇ ਹੁੰਦਾ ਕਿ ਫਿਰ ਗੁੱਲੀ ਡੰਡਾ ਖੇਡਣ ਲੱਗ ਜਾਣਾ ਗੁੱਲੀ ਡੰਡੇ ਲਈ ਵੀ ਉੰਨੇ ਹੀ ਬੱਚੇ ਹੁੰਦੇ ਬਸ ਓਵੇਂ ਹੀ ਖੇਡਦੇ ਰਹਿਣਾ ਇੱਕ ਗੁੱਲੀ ਲੈ ਲੈਣੀ ਗੁੱਲੀ ਘੜ ਲੈਣੀ ਪਹਿਲਾਂ ਇੱਕ ਕਿਸੇ ਦਰੱਖਤ ਤੋਂ ਲੱਕੜ ਵੱਡ ਕੇ ਛੋਟੀ ਗੁੱਲੀ ਬਣਾ ਲੈਣੀ ਫਿਰ ਇੱਕ ਡੰਡਾ ਵੀ ਉੱਥੋਂ ਘੜ ਲੈਣਾ ਵਧੀਆ ਖੇਡਿਆ ਜਾਣਾ ਉਹਦੇ ਵਿੱਚ ਵੀ ਇੱਕ ਬੰਦਾ ਮਤਲਬ ਆਪਣੀ ਟਰਨ ਦਿੰਦਾ ਹੈ